ਹਾਂਜੀ ਸਾਨੂੰ ਆਪਣੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਜ਼ਰੂਰ ਸਿਖਾਉਣੀ ਚਾਹੀਦੀ ਹੈ ਕਿਉਂਕਿ ਪੰਜਾਬੀ ਸਾਡੀ ਮੇਨ ਭਾਸ਼ਾ ਹੈ ਔਰ ਸਾਨੂੰ ਪੰਜਾਬੀ ਆਪਣੇ ਬੱਚਿਆਂ ਨੂੰ ਜ਼ਰੂਰ ਸਿਖਾਉਣੀ ਚਾਹੀਦੀ ਹੈ ਔਰ ਬਾਹਰ ਵੀ ਪੰਜਾਬੀ ਬੋਲਣੀ ਚਾਹੀਦੀ ਹੈ ਹਰੇਕ ਜਗ੍ਹਾ ਪੰਜਾਬੀ ਬਹੁਤ ਅੱਛੀ ਬੋਲੀ ਹੈ ਅਗਰ ਕੋਈ ਬੋਲੇ ਤਾਂ ਪਿਆਰ ਨਾਲ਼ ਬੋਲੇ ਤਾਂ ਪੰਜਾਬੀ ਬਹੁਤ ਅੱਛੀ ਲੈਂਗੁਏਜ਼ ਹੈ ਜੋ ਆਪਾਂ ਨੂੰ ਜ਼ਰੂਰ ਬੋਲਣੀ ਭਾਸ਼ਾ ਏ ਜੋ ਆਪਾਂ ਨੂੰ ਜ਼ਰੂਰ ਬੋਲਣੀ ਚਾਹੀਦੀ ਹੈ ਔਰ ਆਪਣੇ ਬੱਚਿਆਂ ਨੂੰ ਵੀ ਪੰਜਾਬੀ ਜ਼ਰੂਰ ਪੜ੍ਹਾਉਣੀ ਚਾਹੀਦੀ ਹੈ ਅੱਗੇ ਅੱਗੇ ਪੰਜਾਬੀ ਪੰਜਾਬ ਵਿੱਚ ਪੰਜਾਬੀ ਬਹੁਤ ਜ਼ਰੂਰੀ ਆਉਣੀ ਚਾਹੀਦੀ ਹੈ ਹਰ ਹਰ ਬੰਦੇ ਨੂੰ ਪੰਜਾਬੀ ਬੋਲਣੀ ਆਉਣੀ ਹੀ ਚਾਹੀਦੀ ਹੈ ਆਪਣੇ ਬੱਚਿਆਂ ਨੂੰ ਆਪਾਂ ਨੂੰ ਇੰਗਲਿਸ਼ ਹਿੰਦੀ ਦੇ ਨਾਲ਼ ਨਾਲ਼ ਪੰਜਾਬੀ ਵੀ ਜ਼ਰੂਰ ਪੜਾਉਣੀ ਚਾਹੀਦੀ ਹੈ ਉਹਨਾਂ ਨੂੰ ਪੰਜਾਬੀ ਦੀ ਸਿਕਸ਼ਾ ਦੇਣੀ ਚਾਹੀਦੀ ਹੈ ਗੁਰਮੁਖੀ ਦੀ ਸਿਕਸ਼ਾ ਵੀ ਦੇਣੀ ਚਾਹੀਦੀ ਹੈ ਮਤਲਬ ਉਹਨਾਂ ਨੂੰ ਪੰਜਾਬੀ ਦੇ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਜੇ ਉਹ ਪੰਜਾਬ ਦੇ ਹੈ ਪੰਜਾਬ 'ਚ ਰਹਿੰਦੇ ਆ ਤਾਂ ਉਹਨਾਂ ਨੂੰ ਪੰਜਾਬੀ ਬਾਰੇ ਪਤਾ ਹੋਣਾ ਚਾਹੀਦਾ ਕਿ ਪੰਜਾਬੀ ਕੀ ਹੈ ਕੀ ਚੀਜ਼ ਹੈ ਔਰ ਉਹਨਾਂ ਨੂੰ ਪੰਜਾਬੀ ਬੋਲਣੀ ਵੀ ਆਉਣੀ ਚਾਹੀਦੀ ਹੈ